ਵਧੀਆ ਫੋਟੋ ਖਿੱਚਣ ਲਈ ਸਾਨੂੰ ਸਭ ਤੋਂ ਪਹਿਲਾਂ ਤਾਂ ਵਧੀਆ ਕੈਮਰਾ ਹੋਣਾ ਚਾਹੀਦਾ ਹੈ ਅਤੇ ਉਹ ਸਾਫ ਸੁਥਰਾ ਹੋਣਾ ਚਾਹੀਦਾ ਹੈ ਉਸ ਦੀ ਬੈਟਰੀ ਵੀ ਚਾਰਜ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਉਹ ਬੈਕਗਰਾਊਂਡ ਵੀ ਵਧੀਆ ਹੋਣਾ ਚਾਹੀਦਾ ਹੈ ਅਤੇ ਬੰਦੇ ਦੇ ਫ ਕੱਪੜਿਆਂ ਦੇ ਸਟਾਈਲ ਅਤੇ ਕ ਬੰਦੇ ਦੇ ਕੱਪੜੇ ਸਾਫ ਸੁਥਰੇ ਹੋਣੇ ਚਾਹੀਦੇ ਹਨ ਇਸ ਨਾਲ਼ ਅਸੀਂ ਵਧੀਆ ਫੋਟੋ ਖਿੱਚ ਸਕਦੇ ਹਨ ਇਹ ਤਾਂ ਕੈਮਰੇ ਦੀ ਗੱਲ ਹੈ ਜੇਕਰ ਅਸੀਂ ਫੋਨ ਦੀ ਗੱਲ ਕਰੀਏ ਤਾਂ ਫੋਨ 'ਚ ਵੀ ਇੱਦਾਂ ਹੀ ਫੋਟੋ ਸਾਫ ਸੁਥਰੀ ਖਿੱਚ ਸਕਦੇ ਹਨ ਫੋ ਫੋਨ ਦਾ ਕੈਮਰਾ ਸਾਫ ਹੋਣਾ ਚਾਹੀਦਾ ਅਤੇ ਉਸਦੇ ਪਿਕਸਲ ਅਤੇ ਉਸਦਾ ਫੋਕੱਸ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ